ਹਾਂਜੀ ਸੈਲਾਨੀ ਇੱਥੇ ਸੈਰ ਸਪਾਟੇ ਲਈ ਆਉਂਦੇ ਹਨ ਸਾਡੇ ਆਲੇ ਦੁਆਲੇ ਵਿੱਚ ਬਹੁਤ ਸਾਰੇ ਨੇੜੇ ਸਥਾਨ ਹਨ ਜਿੱਥੇ ਸੈਲਾਨੀ ਦੇਖਣ ਆਉਂਦੇ ਹਨ ਜਿਵੇਂ ਕਿ ਕੁਝ ਸਥਾਨ ਹਨ ਕਿਲ੍ਹਾ ਮੁਬਾਰਕ ਹਾਜੀ ਰਤਨ ਮਿਲਕ ਪਲਾਂਟ ਰੋਜ਼ ਗਾਰਡਨ ਚੇਤਕ ਪਾਰਕ ਲੇਕਸ ਛੱਤਬੀੜ ਜ਼ੂ ਪੰਜਵਾਏ ਵਾਟਰ ਪਾਰਕ ਦਮਦਮਾ ਸਾਹਿਬ ਇਹ ਉਹ ਸਥਾਨ ਹਨ ਜਿੱਥੇ ਸੈਲਾਨੀ ਦੇਖਣ ਲਈ ਆਉਂਦੇ ਹਨ ਜੇ ਮੈਂ ਗੱਲ ਕਰਾਂ ਕਿਲ੍ਹਾ ਮੁਬਾਰਕ ਦੀ ਕਿਲ੍ਹਾ ਮੁਬਾਰਕ ਜੋ ਹੈ ਇਸ ਨੂੰ ਬਹੁਤ ਇਤਿਹਾਸਿਕ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ ਇੱਥੇ ਇੱਕ ਗੁਰਦੁਆਰਾ ਸਾਹਿਬ ਵੀ ਹੈ ਇਸ ਨੂੰ ਬਠਿੰਡੇ ਦੀ ਸਭ ਤੋਂ ਉੱਚੀ ਇਮਾਰਤ ਮੰਨਿਆ ਜਾਂਦਾ ਹੈ ਇਸ ਗੁਰਦੁਆਰਾ ਕਿਲ੍ਹਾ ਮੁਬਾਰਕ ਵਿੱਚ ਖੜ੍ਹ ਕੇ ਅਸੀਂ ਬਠਿੰਡੇ ਦਾ ਪੂਰਾ ਜੋ ਹੈ ਦ੍ਰਿਸ਼ ਦਾ ਆਨੰਦ ਮਾਣ ਸਕਦੇ ਹਾਂ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਇੱਥੇ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਛੋਹ ਹੈ ਜੋ ਪ੍ਰਾਪਤ ਕੀਤੇ ਸਨ ਅਤੇ ਇੱਥੇ ਜੋ ਹੈ ਗੁਰੂ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਸੀ ਜੇ ਮੈਂ ਗੱਲ ਕਰਾਂ ਰੋਜ਼ ਗਾਰਡਨ ਦੀ ਤਾਂ ਰੋਜ਼ ਗਾਰਡਨ ਵਿੱਚ ਤਰ੍ਹਾਂ ਤਰ੍ਹਾਂ ਦੇ ਬਹੁਤ ਸਾਰੇ ਫਲਾਵਰ ਜੋ ਹੈ ਲੱਗੇ ਹੋਏ ਹਨ ਲੇਕਸ ਲੇਕਸ ਦਾ ਵਿਊ ਸ਼ਾਮ ਨੂੰ ਦੇਖਣ ਵਾਲਾ ਬਹੁਤ ਸੋਹਣਾ ਹੁੰਦਾ ਹੈ ਇੱਥੇ ਅਕਰਸ਼ਕ ਦੇਖਣ ਲਈ ਆਉਂਦੇ ਹਨ ਅਤੇ ਇੱਥੇ ਬੋਸ ਜੋ ਹੈ ਲੋਕ ਕਿਸ਼ਤੀਆਂ ਉੱਪਰ ਝੂਟੇ ਵੀ ਲੈਂਦੇ ਹਨ ਜੇ ਮੈਂ ਗੱਲ ਕਰਾਂ ਪੰਜੋਆਏ ਵਾਟਰ ਪਾਰਕ ਦੀ ਤਾਂ ਪੰਜੋਆਏ ਵਾਟਰ ਪਾਰਕ ਜੋ ਹੈ ਉਹ ਲਹਿਰਾ ਮੁਹੱਬਤ ਵਿੱਚ ਜੋ ਹੈ ਉਹ ਬਣਿਆ ਹੋਇਆ ਹੈ ਉਸ ਵਿੱਚ ਜੋ ਪੈਸੇ ਜੋ ਟਿਕਟ ਹੈ ਉਹ ਘੱਟ ਹੋਣ ਕਰਕੇ ਬਹੁਤ ਸਾਰੇ ਜੋ ਲੋਕ ਹੈ ਉੱਥੇ ਜਾਂਦੇ ਹਨ ਅਤੇ ਉੱਥੇ ਅਨੰਦ ਮਾਣਦੇ ਹਨ